ਮੈਂ ਆਪਣੇ ਰਾਜ ਪੰਜਾਬ ਤੋਂ ਇਲਾਵਾ ਜੰਮੂ ਕਸ਼ ਅਤੇ ਕਸ਼ਮੀਰ ਗਿਆ ਹਾਂ ਮੇਰੇ ਉੱਥੇ ਜਾਣ ਦਾ ਉਦੇਸ਼ ਉਸ ਦੀ ਸੁੰਦਰਤਾ ਖੂਬਸੂਰਤੀ ਅਤੇ ਉੱਥੇ ਬਹੁਤ ਹੀ ਪ੍ਰਸਿੱਧ ਥਾਵਾਂ 'ਤੇ ਘੁੰਮਣਾ ਅਤੇ ਉਹਨਾਂ ਬਾਰੇ ਜਾਣਨਾ ਸੀ ਮੈਂ ਕਸ਼ਮੀਰ ਵਿੱਚ ਉਸ ਦੀ ਸੁੰਦਰਤਾ ਨੂੰ ਦੇਖਣ ਗਿਆ ਸੀ ਜਿਵੇਂ ਕਿਹਾ ਜਾਂਦਾ ਹੈ ਕਿ ਕਸ਼ਮੀਰ ਭਾਰਤ ਦਾ ਸਵਰਗ ਹੈ ਜਿਸ ਨੂੰ ਆਪਾਂ ਬਿਨਾਂ ਮਰੇ ਵੇਖ ਸਕਦੇ ਹਾਂ ਇਸ ਕਰਕੇ ਮੈਂ ਜੰਮੂ ਅਤੇ ਕਸ਼ਮੀਰ ਗਿਆ ਸੀ ਕਸ਼ਮੀਰ ਨੂੰ ਉਸ ਦੀ ਝੀਲਾਂ ਪਹਾੜ ਫ਼ਲ ਅਤੇ ਫਰੂਟ ਦੇ ਬਾਗਾਂ ਕਾਰਨ ਉਹ ਕਸ਼ਮੀਰੀ ਨੂੰ ਸੁੰਦਰ ਬਣਾਉਂਦੀ ਹੈ ਇਸ ਕਰਕੇ ਕਸ਼ਮੀਰ ਵਿੱਚ ਘੁੰਮਣ ਦਾ ਉਦੇਸ਼ ਮੇਰਾ ਉੱਥੋਂ ਦੀ ਸੁੰਦਰਤਾ ਨੂੰ ਦੇਖਣਾ ਅਤੇ ਉੱਥੋਂ ਦੇ ਵਾਤਾਵਰਨ ਵਿੱਚ ਰਹਿਣਾ ਸੀ ਜਿਸ ਨਾਲ ਮੈਨੂੰ ਉੱਥੋਂ ਦੇ ਵਾਤਾਵਰਨ ਵਿੱਚ ਰਹਿ ਕੇ ਉੱਥੋਂ ਦੇ ਸਕੂਨ ਨੂੰ ਵੇਖ ਕੇ ਮੇਰਾ ਮਨ ਬਹੁਤ ਖੁਸ਼ ਹੋਇਆ ਅਤੇ ਮੈਨੂੰ ਬਹੁਤ ਹੀ ਜਾਣਕਾਰੀ ਮਿਲੀ ਉਸ ਦੀ ਡੱਲ ਲੇਕ ਬਹੁਤ ਹੀ ਮਸ਼ਹੂਰ ਹੈ ਅਤੇ ਉੱਥੇ ਸ਼ਿਕਾ